ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਬੇਟਾ ਐਕਚੁਲੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਇਕੱਠੇ ਕੀਤਾ ਬਹੁਤ ਦੂਰੋਂ ਦੂਰੋਂ ਲੋਕ ਆਏ ਅਤੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵੀ ਬਹੁਤ ਬਹਾਦਰ ਸਿੱਖ ਹੈ ਤਾਂ ਉਹ ਮੇਰੇ ਸਾਹਮਣੇ ਆਵੇ ਤਾਂ ਪਹਿਲਾਂ ਤਾਂ ਸਾਰੇ ਡਰ ਗਏ ਕਿ ਮੈਂ ਆਪਣੀ ਸ਼ਹੀਦੀ ਕਿੱਦਾਂ ਦੇ ਦੇਵਾਂ ਫਿਰ ਇੱਕ ਪਿਆਰਾ ਸਿੱਖ ਆਇਆ ਪਹਿਲੇ ਅਤੇ ਉਹਨਾਂ ਨੇ ਕਿਹਾ ਕਿ ਹਾਂ ਮੈਂ ਆਪਣੀ ਮਤਲਵ ਮੈਂ ਤੁਹਾਨੂੰ ਆਪਣੇ ਆਪ ਨੂੰ ਸੋਂਪ ਸਕਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਅੰਦਰ ਲੈ ਗਏ ਅੰਦਰ ਲਿਆ ਕੇ ਗਏ ਤਾਂ ਉਸ ਤੋਂ ਬਾਅਦ ਜਿੱਦਾਂ ਥੋੜ੍ਹੀ ਦੇਰ ਬਾਅਦ ਬਾਹਰ ਆਏ ਜਿਹੜੀ ਤਲਵਾਰ ਸੀਗੀ ਉਹ ਖੂਨ ਨਾਲ ਮਤਲਬ ਭਰੀ ਹੋਈ ਸੀਗੀ ਅਤੇ ਸਾਰੇ ਡਰ ਗਏ ਉਸ ਚੀਜ਼ ਨੂੰ ਦੇਖ ਕੇ ਤਾਂ ਫਿਰ ਉਹ ਕਹਿੰਦੇ ਮੈਨੂੰ ਇੱਕ ਹੋਰ ਸਿੱਖ ਪਿਆਰਾ ਚਾਹੀਦਾ ਤਾਂ ਫਿਰ ਇੱਕ ਹੋਰ ਲੈ ਕੇ ਗਏ ਫਿਰ ਉਦਾਂ ਹੀ ਮਤਲਬ ਜਿਹੜੀ ਤਲਵਾਰ ਸੀ ਉਹ ਲੈ ਕੇ ਆਏ ਅਤੇ ਕਹਿੰਦੇ ਮੈਨੂੰ ਇੱਕ ਹੋਰ ਚਾਹੀਦਾ ਇੱਦਾਂ ਤਿੰਨ ਚਾਰ ਪੰਜ ਵਾਰ ਲੈ ਕੇ ਗਏ ਅੰਦਰ ਤਾਂ ਸਾਰੇ ਲੋਕ ਡਰੇ ਹੋਏ ਵੀ ਹੁਣ ਫਿਰ ਇਨ੍ਹਾਂ ਨੇ ਕੁਛ ਬੋਲਣਾ ਤਾਂ ਅਸੀਂ ਕੀ ਕਰਾਂਗੇ ਤਾਂ ਥੋੜ੍ਹੀ ਦੇਰ ਬਾਅਦ ਜਦੋਂ ਪੰਡਾਲ ਵਿੱਚੋਂ ਬਾਹਰ ਲੈ ਕੇ ਆਏ ਸਾਰੇ ਪਿਆਰੇ ਪੰਜ ਪਿਆਰੇ ਕਹਿੰਦੇ ਮੈਂ ਇਹਨਾਂ ਨੂੰ ਆਪਣਾ ਅੰਮ੍ਰਿਤ ਛਕਾਉਂਗਾ ਅਤੇ ਇਹ ਮੇਰੇ ਮਤਲਬ ਹੁਣ ਮੈਂ ਇਹ ਮੈਨੂੰ ਛਕਾਉਣਗੇ ਅਤੇ ਇਹ ਮੇਰੇ ਮੈਂ ਇਹਨਾਂ ਦਾ ਚੇਲਾ ਬਣ ਗਿਆ ਇਹ ਮੇਰੇ ਗੁਰੂ ਬਣ ਗਏ ਤਾਂ ਇੱਦਾਂ ਉਹਨਾਂ ਨੇ ਆਪਣਾ ਖਾਲਸਾ ਪੰਥ ਸਜਾਇਆ ਸੀਗਾ ਅਤੇ ਕਹਿੰਦੇ ਕੋਈ ਵੀ ਬੰਦਾ ਇਸ ਤੋਂ ਡਰੇਗਾ ਉਹ ਇਹ ਸਾਰਿਆਂ ਦੀ ਰੱਖਿਆ ਕਰੂੰਗੇ ਇੱਦਾਂ ਦਾ ਉਹਨਾਂ ਨੇ ਸੀਨ ਕ੍ਰੀਏਟ ਕੀਤਾ ਉਸ ਤੋਂ ਬਾਅਦ ਸਾਰੇ ਸਿੱਖ ਜਿਹੜੇ ਹੈਗੇ ਆ ਉਹ ਆਪਣਾ ਸੋਲ੍ਹਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ ਯਾਦ ਕਰਕੇ ਸਾਰੇ ਵਿਸਾਖੀ ਦਾ ਮੇਲਾ ਮਨਾਉਂਦੇ ਹੈ ਅਤੇ ਨਾਲੇ ਕਣਕ ਕਣਕ ਜਦੋਂ ਪੱਕ ਜਾਂਦੀ ਹੈ ਉਹ ਹੀ ਜਿਹੜੇ ਜੱਟ ਹੁੰਦੇ ਆ ਜਾਂ ਸਾਰੇ ਉੱਦਾਂ ਮਤਲਬ ਮਨਾਉਂਦੇ ਆ ਜਿਹਨੂੰ ਕਿ ਵਿਸਾਖੀ ਹੈ ਵਿਸਾਖੀ ਦਾ ਮੇਲਾ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਅਨੰਦਪੁਰ ਸਾਹਿਬ ਜਾਂਦੇ ਆ ਕਿਉਂਕਿ ਅਨੰਦਪੁਰ ਸਾਹਿਬ ਵਿੱਚ ਇਹ ਸਾਕਾ ਹੋਇਆ ਸੀ ਹੋਰ ਕੁਛ ਬੇਟਾ ਹਾਂਜੀ ਉਹਦੇ ਨਾਲ ਦਾ ਈਵੈਂਟ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਸਾਰੇ ਇੱਕੋ ਰੰਗ ਵਿੱਚ ਮਿਲ ਜਾਣ ਇਸ ਕਰਕੇ ਉਹ ਖਾਲਸਾ ਪੰਥ ਦੀ ਐਕਚੁਲੀ ਉਹਨਾਂ ਨੇ ਤਾਂ ਕੀਤੀ ਸੀ ਕਿ ਦੂਰੋਂ ਹੀ ਮੇਰਾ ਜਿਹੜਾ ਸਿੱਖ ਹੈਗਾ ਉਹ ਦੂਰੋਂ ਹੀ ਪਹਿਚਾਣਿਆ ਜਾਵੇ ਪਗੜੀ ਕਰਕੇ ਵੀ ਦੂਰੋ ਹੀ ਲੋਕ ਕਹਿਣ ਕਿ ਹਾਂ ਉਹ ਹਜ਼ਾਰਾਂ ਵਿੱਚੋਂ ਗਿਣਤੀ ਦੇ ਵਿੱਚੋਂ ਵੀ ਲੋਕ ਪਹਿਚਾਣ ਸਕਣ ਵੀ ਉਹ ਦੇਖੋ ਇੱਕ ਸਿੱਖ ਖੜਾ ਹੋਇਆ ਹੈ

ਹਾਂ ਹਾਂ ਹਾਂਜੀ ਫਿਰ ਹੌਲੀ ਹੌਲੀ ਸ਼ੁਰੂਆਤ ਕੀਤੀ ਉਹਨਾਂ ਨੇ ਸਾਰਾ ਕੁਛ ਅਤੇ ਹੁਣ ਮਤਲਬ ਅੱਜ ਦੀ ਡੇਟ ਵਿੱਚ ਜਿਹੜੇ ਪੰਜ ਪਿਆਰੇ ਹੈ ਉਹ ਜਿਹਨੇ ਵੀ ਅੰਮ੍ਰਿਤ ਛਕਣਾ ਉਹ ਪੰਜ ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਹੈ ਉਸ ਤੋਂ ਬਾਅਦ ਉਹ ਆਪਣਾ ਮਤਲਬ ਪੰਜ ਕਰਾਰਾਂ ਪਾਉਂਦੇ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਉਹ ਪਾਠ ਪੂਜਾ ਸਭ ਕੁਛ ਦੱਸਦੇ ਆ ਵੀ ਆਹ ਪਾਠ ਕਰਨਾ ਇੱਦਾਂ ਕਰਨਾ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਨਾ ਹੈ ਪੰਜ ਪੌੜੀਆਂ ਦਾ ਪਾਠ ਕਰਨਾ ਇੱਦਾਂ ਸਾਰਾ ਕੁਛ ਸ਼ਾਮ ਨੂੰ ਫਿਰ ਸਾਨੂੰ ਤਾਕੀਦ ਕਰਦੇ ਆ ਕਿ ਰਹਿਰਾਸ ਸਾਹਿਬ ਕਰਨਾ ਹੀ ਕਰਨਾ ਇਹ ਤਾਂ ਕਪਲਸ਼ਨ ਹੈ ਤਾਂ ਤੁਸੀਂ ਹੋਰ ਵੀ ਕਰਨਾ ਚਾਹੁੰਦੇ ਹੋ ਗੁਰੂ ਗ੍ਰੰਥ ਸਾਹਿਬ 'ਚੋਂ ਉਹ ਵੀ ਕਰ ਸਕਦੇ ਓਂ ਅਤੇ ਪਰ ਇਹ ਤਾਂ ਬਹੁਤ ਜ਼ਰੂਰੀ ਹੈ ਮਤਲਬ ਡੇਲੀ ਇੰਨਾ ਪਾਠ ਸਵੇਰੇ ਕਰਨਾ ਔਰ ਸ਼ਾਮ ਨੂੰ ਕਰਨਾ ਇੱਦਾਂ ਜ਼ਰੂਰੀ ਹੈ ਤਾਕੀਦ ਕੀਤੀ ਜਾਂਦੀ ਹੈ ਖਾਲਸਾ ਜੀ ਫੋ ਫੋ ਫੌਜ ਨੂੰ ਇਹ ਕਿਹਾ ਜਾਂਦਾ ਕਿ ਉਹ ਸਾਰੇ ਇਸ ਪੰਥ ਵਿੱਚ ਹੈ ਜਿਹੜੇ ਨਿਡਰ ਹੈ ਕਿਸੇ ਦੀ ਹੈਲਪ ਕਰਨ ਲਈ ਠੀਕ ਹੈ ਕਿਸੇ ਦੀ ਧੀ ਭੈਣ ਨੂੰ ਕੋਈ ਚੁੱਕ ਕੇ ਲੈ ਜਾਂਦਾ ਸੀ ਅਤੇ ਜਿਹੜੇ ਸਿੱਖ ਸੀਗੇ ਉਹ ਜਾ ਕੇ ਬਚਾ ਕੇ ਲੈ ਕੇ ਆਉਂਦੇ ਸੀ ਉਹ ਇਹ ਨਹੀਂ ਵੇਖਦੇ ਸੀ ਕਿਹੜੇ ਪੰਥ ਦਾ ਇਹ ਲੜਕੀ ਹੈ ਜਾਂ ਕਿੱਦਾਂ ਹੈ ਉਹਨਾਂ ਨੂੰ ਹਮੇਸ਼ਾ ਬਚਾ ਕੇ ਲੈ ਕੇ ਆਉਂਦੇ ਹੁੰਦੇ ਸੀਗੇ ਉਹ ਲਿਆਂਦੇ ਵੀ ਸੀਗੇ ਹੁਣ ਵੀ ਅੱਜ ਦੀ ਡੇਟ 'ਚ ਵੀ ਕਿਸੇ ਵੀ ਸਿੱਖ ਦੇ ਮਤਲਬ ਉਹ ਹੈਲਪ ਹੀ ਕਰਨਗੇ ਉਹ ਕਿਸੇ ਦੀ ਧੀ ਨੂੰ ਤੰਗ ਨਹੀਂ ਕਰਨਗੇ ਇਹ ਮੰਨਿਆ ਜਾਂਦਾ ਓਕੇ ਓਕੇ ਬੇਟਾ ਓਕੇ ਓਕੇ ਬਾਏ